ਹਾਂਜੀ ਮੈਮ ਮੈਂ ਆਰਿਅਨ ਦੇ ਪੇਰੈਂਟ ਗੱਲ ਕਰ ਰਹੀ ਹਾਂ ਕਿ ਮੈਂ ਉਹਨੂੰ ਪੁੱਛਣਾ ਸੀਗਾ ਕਿ ਕੋਈ ਇਮਪਰੂਵਮੈਂਟ ਨਹੀਂ ਹੋ ਰਹੀ ਉਹਦੇ 'ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਮ

ਹਾਂਜੀ ਮੈਮ ਕੀ ਪ੍ਰੋਬਲਮ ਆ ਰਹੀ ਪਲੀਜ਼ ਐਕਸਪਲੇਨ ਕਰੋਗੇ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਜੀ

ਨਹੀਂ ਮੈਮ ਤੁਸੀਂ ਪਹਿਲਾਂ ਵੀ ਉਹਨਾਂ ਨੂੰ ਬੋਲਿਆ ਉਹਨਾਂ ਦੇ ਗ੍ਰੈਂਡ ਪੇਰੈਂਟਸ ਤੋਂ ਇਹਨਾਂ ਦੇ ਦਾਦਾ ਦਾਦੀ ਜੀ ਨੂੰ ਪਹਿਲਾਂ ਨਹੀਂ ਬੋਲਿਆ ਕਿ ਪਲੀਜ਼ ਇੱਦਾਂ ਇੱਦਾਂ ਡਿਸਟਰਬੈਂਸ ਨਾ ਕਰੋ ਹਾਂਜੀ ਔਰ ਤੁਸੀਂ ਵੀ ਮੈਮ ਮੇਰੇ ਨਾਲ ਗੱਲ ਨਹੀਂ ਕੀਤੀ ਪਹਿਲਾਂ ਹਾਂਜੀ ਹਾਂਜੀ ਬਟ ਮੈਮ ਮੈਂ ਤਾਂ ਤੁਹਾਨੂੰ ਪੇ ਕਰ ਰਹੀ ਹਾਂ ਕਿ ਤੁਸੀਂ ਇਹਨੂੰ ਸਾਰਾ ਡਾਂਸ ਮਤਲਬ ਤੁਸੀਂ ਫੋਕ ਡਾਂਸ ਦੇ ਉੱਪਰ ਹੀ ਇਹਦਾ ਜ਼ਿਆਦਾ ਫੋਕਸ ਕਰਨਾ ਹੈ ਹਾਂਜੀ

ਹਾਂਜੀ ਪਰ ਮੈਂ ਹਾਂਜੀ ਹਾਂਜੀ ਹਾਂਜੀ ਹੋਰ ਕੀ ਪ੍ਰੋਬਲਮਸ ਆ ਰਹੀਆਂ ਮੈਮ ਹਾਂਜੀ ਹਾਂਜੀ ਪਰ ਮੈਮ ਤੁਹਾਨੂੰ ਇਸ ਰਿਕਾਡਿੰਗ ਮੇਰੇ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਓਲਰੇਡੀ ਵਨ ਮੰਥ ਹੋ ਗਿਆ ਹੁਣ ਤੁਹਾਡੀ ਫੀਸ ਵੀ ਦੇਣ ਵਾਲੀ ਹੋ ਗਈ ਹੈ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਇਹ ਜਿਹੜਾ ਘਰ ਦੇ ਵਿੱਚ ਪ੍ਰੋਬਲਮ ਆ ਰਹੀ ਇਹ ਥੋੜ੍ਹਾ ਜਿਹਾ ਤੁਸੀਂ ਕਹਿ ਦਿਆ ਕਰੋ ਕੋਈ ਇੰਨੀ ਮਾਇੰਡ ਵਾਲੀ ਗੱਲ ਨਹੀਂ ਹੈ ਔਰ ਮੈਮ ਬੱਚੇ ਲਈ ਕੋਈ ਪ੍ਰੋਬਲਮ

ਹਾਂਜੀ ਹਾਂਜੀ ਹਾਂਜੀ ਔਰ ਬੱਚਾ ਮੈਮ ਪਿਕ ਕਰ ਰਿਹਾ ਚੰਗੀ ਤਰ੍ਹਾਂ ਜੋ ਤੁਸੀਂ ਕਰਾ ਰਹੇ ਹੋ ਹਾਂਜੀ ਕਿਉਂਕਿ ਮੈਂ ਜਦੋਂ ਉਹਨੂੰ ਕਰਵਾ ਕੇ ਦੇਖ ਰਹੀ ਸੀ ਤਾਂ ਉਹਦੀ ਪਰਫੋਰਮੈਂਸ ਮੈਨੂੰ ਠੀਕ ਨਹੀਂ ਲੱਗੀ ਹਾਂਜੀ ਹਾਂਜੀ ਹਾਂਜੀ ਓਕੇ ਮੈਮ ਮੇਨ ਤੁਹਾਨੂੰ ਇਨਵਾਇਰਮੈਂਟ ਦੀ ਆ ਰਹੀ ਪ੍ਰੋਬਲਮ ਹਾਂਜੀ ਠੀਕ ਹੈ ਮੈਮ ਠੀਕ ਹੈ ਮੈਮ ਓਕੇ ਜੀ ਥੈਂਕ ਯੂ ਮੈਮ ਮੈਂ ਕਰਦੀ ਹਾਂ ਥੋੜ੍ਹਾ ਜਿਹਾ ਇਹਨਾਂ ਨੂੰ ਸਮਝਾਉਂਦੀ ਠੀਕ ਹੈ ਓਕੇ ਜੀ ਓਕੇ ਜੀ ਥੈਂਕ ਯੂ